ਆਪਣੇ ਸੁਰਾਂ ਦੀ ਗਹਿਰਾਈ ਨੂੰ ਵਧਾਉਣ ਦਾ ਤਰੀਕਾ ਚੰਗਾ ਗੁਰੂ ਜਿਹੜਾ ਚੰਗਾ ਸਿੱਖਿਆ ਹੋਇਆ ਗੁਰੂ ਹੋਵੇ ਉਹਦੇ ਕੋਲੋਂ ਅਸੀਂ ਸਿਖ ਸਕਦੇ ਹਾਂ ਚੰਗਾ ਗਾਉਣ ਦਾ ਅਤੇ ਸਭ ਤੋਂ ਜ਼ਰੂਰੀ ਜਿਹੜਾ ਹੈ ਇਹਦੇ ਲਈ ਰਿਆਜ਼ ਰਿਆਜ਼ ਜਿਹੜਾ ਉਹ ਬਹੁਤ ਜ਼ਰੂਰੀ ਇੱਕ ਰਿਆਜ਼ ਇੱਕ ਤਪੱਸਿਆ ਹੀ ਹੁੰਦੀ ਆ ਜਿਵੇਂ ਤਪੱਸਿਆ ਕਰਨ ਤੋਂ ਬਾਅਦ ਫਲ ਮਿਲਦਾ ਹੈ ਨਾ ਇੱਦਾਂ ਹੀ ਰਿਆਜ਼ ਤੁਹਾਡੇ ਲਈ ਇੱਕ ਬਹੁਤ ਜ਼ਰੂਰੀ ਚੀਜ਼ ਆ ਜਿਹੜਾ ਸਵੇਰੇ ਉੱਠ ਕੇ ਦੋ ਢਾਈ ਵਜੇ ਉੱਠ ਕੇ ਰਿਆਜ਼ ਕੀਤਾ ਜਾਵੇ ਇੱਕ ਆਪਣੀ ਆਵਾਜ਼ ਨੂੰ ਲੈਅ 'ਚ ਕੀਤਾ ਜਾਵੇ ਅ ਅਤੇ ਲੰਬੇ ਸਾਹ ਲਏ ਜਾਣ ਉਹਦੇ ਲਈ ਲੰਬੇ ਸਾਹਵਾਂ ਦੀ ਪ੍ਰੈਕਟਿਸ ਕਰਨੀ ਇੱਕ ਯੋਗ ਵੀ ਹੈ ਰਿਆਜ਼ ਤੁਹਾਡੇ ਲਈ ਇਸ ਕਰਕੇ ਰਿਆਜ਼ ਜਿਹੜਾ ਵਾ ਉਹ ਬਹੁਤ ਜ਼ਰੂਰੀ ਆ ਸਿੰਗਿੰਗ ਵਾਸਤੇ ਰਿਆਜ਼ ਤੁਸੀਂ ਸਵੇਰੇ ਉੱਠ ਕੇ ਕਰੋ ਜਾਂ ਸ਼ਾਮ ਨੂੰ ਕਰੋ ਲੰਬੇ ਲੰਬੇ ਸਾਹ ਲਓ ਉਹਦੇ ਲਈ ਤੁਹਾਡੇ ਜਿਹੜੇ ਸ ਸੁਰ ਅੱਛੇ ਹੋ ਸਕਦੇ ਆ ਅਤੇ ਚੰਗਾ ਗੁਰੂ ਹੋਵੇ ਜਿਹੜਾ ਤੁਹਾਨੂੰ ਦੱਸੇ ਵੀ ਕਿੱਦਾਂ ਰਿਆਜ਼ ਕੀਤਾ ਜਾ ਸਕਦਾ ਅਤੇ ਮੈਂ ਤਾਂ ਇਹ ਹੀ ਸਮਝਦਾਂ ਵੀ ਜਿਹੜਾ ਰਿਆਜ਼ ਆ ਉਹ ਹੀ ਸਿੰਗਿੰਗ ਨੂੰ ਆਪਣੇ ਨੂੰ ਅੱਗੇ ਵਧਾ ਸਕਦੇ ਹਾਂ ਅਤੇ ਰਿਆਜ਼ ਜਿਹੜਾ ਉਹ ਹੀ ਤੁਹਾਡੀ ਗਾਇਕੀ ਨੂੰ ਚਾਰ ਚੰਨ ਲਗਾ ਸਕਦਾ ਅਤੇ ਉਹਦੇ ਲਈ ਸਵੇਰੇ ਉੱਠ ਕੇ ਰਿਆਜ਼ ਕਰੋ ਮਿਹਨਤ ਕਰੋ ਤਾਂ ਹੀ ਇੱਕ ਅੱਛਾ ਸਿੰਗਰ ਬਣ ਸਕਦਾ ਅਤੇ ਸੁਰਾਂ ਨੂੰ ਸਾਧਿਆ ਜਾ ਸਕੇ ਜਿਹਦੇ ਨਾਲ ਇਸ ਕਰਕੇ ਰਿਆਜ਼ ਜਿਹੜਾ ਮੋਸਟਲੀ ਸਵੇਰੇ ਉੱਠ ਕੇ ਕਰੋ ਤਾਂ ਕਿ ਤੁਹਾਡੀ ਆਵਾਜ਼ ਇੱਕ ਲੈਅ 'ਚ ਆਵੇ ਅਤੇ ਤੁਸੀਂ ਅੱਛਾ ਗਾ ਸਕੋ